ਸਤਿ ਸ਼੍ਰੀ ਅਕਾਲ ਜੀ ਰੈਡਮੀ ਦੇ ਸਟੋਰ ਤੋਂ ਗੱਲ ਕਰ ਰਹੇ ਜੀ ਅਸੀਂ ਤੁਹਾਡੇ ਸਟੋਰ ਤੋਂ ਰੈਡਮੀ ਨਾਈਨ ਪਰਾਈਮ ਫੋਨ ਦਾ ਓਡਰ ਦਿੱਤਾ ਸੀ ਜੀ ਅਤੇ ਫੋਨ ਬਹੁਤ ਵਧੀਆ ਏ ਜੀ ਉਸ ਦੀ ਪੈਕੇਜਿੰਗ ਬਹੁਤ ਵਧੀਆ ਸੀ ਕੈਮਰਾ ਕੁਆਲਟੀ ਬਹੁਤ ਵਧੀਆ ਹੈ ਕਲੈਰੇਟੀ ਬਹੁਤ ਹੈ ਕੈਮਰੇ ਦੀ ਬਿਲਕੁਲ ਵੀ ਹੈਂਗ ਨਹੀਂ ਹੁੰਦਾ ਬੈਟਰੀ ਬੈਕਅੱਪ ਵੀ ਬਹੁਤ ਵਧੀਆ ਪੂਰਾ ਦਿਨ ਚਾਰਜਿੰਗ ਖਤਮ ਨਹੀਂ ਹੁੰਦੀ ਉਸ ਦੀ ਅਤੇ ਉਸ ਦਾ ਪ੍ਰੋਸੈਸਰ ਆ ਸਨੈਪ ਡ੍ਰੈਗਨ ਸਿਕਸ ਫਿਫਟੀ ਉਹ ਵੀ ਬਹੁਤ ਵਧੀਆ ਹੈ ਜਿਸ ਦੇ ਫੋਨ ਜਮ ਬਿਲਕੁਲ ਵੀ ਹੈਂਗ ਨਹੀਂ ਹੋ ਰਿਹਾ ਸਾਰਾ ਫੋਨ ਬਹੁਤ ਵਧੀਆ ਸਮੂਥਲੀ ਚੱਲ ਰਿਹਾ ਹੈ ਧੰਨਵਾਦ